ਮੈਂ ਪੈੱਨ ਨਾਲ ਲਿਖਣਾ ਪਸੰਦ ਕਰਦਾ ਹਾਂ ਕਿਉਂਕਿ ਜੇ ਅਸੀਂ ਮੋਬਾਇਲ ਦੇ ਅਸੀਂ ਟਾਈਪ ਕਰਦੇ ਰਹੀਏ ਤਾਂ ਸਾਨੂੰ ਉਸ ਦੀ ਆਦਤ ਪੈ ਜੇਗੀ ਅਤੇ ਸਾਨੂੰ ਲਿਖਣ ਦੀ ਆਦਤ ਨਹੀਂ ਰਹੇਗੀ ਅਤੇ ਸਾਡੇ ਹੱਥਾਂ ਵਿੱਚ ਕਾਫੀ ਦਰਦ ਰਵੇਗੀ ਕਿਉਂਕਿ ਜਿਵੇਂ ਅਸੀਂ ਲਿਖਦੇ ਰਹਿੰਦੇ ਹਾਂ ਤਾਂ ਸਾਡੇ ਹੱਥ ਨੂੰ ਪ੍ਰੈਕਟਿਸ ਹੋਈ ਰਹਿੰਦੀ ਹੈ ਕਿ ਅਤੇੇ ਸਾਡਾ ਹੱਥ ਕਾਫੀ ਵੱਡੇ ਵੱਡੇ ਕੰਮ ਕਰ ਲੈਂਦਾ ਹੈ ਪਰ ਜੇ ਅਸੀਂ ਹੁਣ ਇਹਦੇ ਨਾਲ ਨਾ ਕਰੀਏ ਅਤੇ ਫਿਰ ਸਾਡਾ ਹੱਥ ਕੋਈ ਕੰਮ ਨਹੀਂ ਕਰ ਪਾਵੇਗਾ ਅਤੇ ਅਸੀਂ ਕੁਛ ਨਹੀਂ ਕਰ ਪਾਵਾਂਗੇ ਅਤੇ ਉਹੀ ਮੈਂ ਕਹਿੰਦਾ ਕਿ ਸਾਨੂੰ ਹੱਥ ਦਾ ਉਪਯੋਗ ਕਰਕੇ ਲਿਖਣਾ ਚਾਹੀਦਾ ਹੈ ਪੈੱਨ ਨਾਲ ਕਾਗਜ਼ 'ਤੇ ਕਾਗਜ਼ 'ਤੇ ਲਿਖਣਾ ਚਾਹੀਦਾ ਨਾ ਕਿ ਸਾਨੂੰ ਜ਼ਿਆਦਾ ਟਾਈਪ ਕਰਨਾ ਚਾਹੀਦਾ ਬਾਕੀ ਜ਼ਿਆਦਾ ਟਾਈਪ ਕਰਦੇ ਰਹਿ ਜਾਂਗੇ ਅਤੇ ਸਾਨੂੰ ਅੱਖਾਂ 'ਤੇ ਵੀ ਇਫੈਕਟ ਪਏਗਾ ਅਤੇ ਸਾਨੂੰ ਜੇ ਜ਼ਿਆਦਾ ਸਕਰੀਨ ਟਾਈਮ ਹੋ ਗਿਆ ਸਾਡਾ ਅੱਖਾਂ 'ਤੇ ਬਹੁਤ ਇਫੈਕਟ ਪਏਗਾ ਸਾਡੀਆਂ ਅੱਖਾਂ ਖਰਾਬ ਵੀ ਹੋ ਸਕਦੀਆਂ ਤਾਂ ਮੈਂ ਕਹਿੰਦਾ ਏ ਕਿ ਟਾਈਪਿੰਗ ਦੀ ਆਦਤ ਸਾਨੂੰ ਬਹੁਤ ਘੱਟ ਕਰਨੀ ਚਾਹੀਦੀ ਹੈ ਸਾਨੂੰ ਲਿਖਣ ਦੀ ਆਦਤ ਕਾਫੀ ਘੱਟ ਕਰਨੀ ਚਾਹੀਦੀ ਹੈ ਅਤੇ ਹਮੇਸ਼ਾਂ ਸਾਨੂੰ ਪੈੱਨ ਅਤੇ ਕਾਗਜ਼ ਨਾ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਇਹ ਮੈਂ ਮੰਨਦਾ